ਵੈਸੇ ਤਾਂ ਅਗਰ ਗੱਲ ਕੀਤੀ ਜਾਵੇ ਮੁੱਢਲੀ ਪੜ੍ਹਾਈ ਦੀ ਤਾਂ ਮੈਂ ਮੁੱਢਲੀ ਪੜ੍ਹਾਈ ਆਪਣੇ ਪਿੰਡ ਤੋਂ ਹੀ ਪ੍ਰਾਪਤ ਕੀਤੀ ਹੈ ਪੰਜਵੀਂ ਮੈਂ ਬੋਰਡ ਦੀ ਕੀਤੀ ਹੈ ਅੱਠਵੀ ਦਸਵੀਂ ਬੋਰਡ ਦੀ ਕੀਤੀ ਹੈ ਅਤੇ ਪਲੱਸ ਟੂ ਤੱਕ ਪੜ੍ਹਾਈ ਕੀਤੀ ਹੈ ਮੈਂ ਆਪਣੀ ਮੁੱਢਲੀ ਪਿੰਡ ਤੋਂ ਹੀ ਪ੍ਰਾਪ ਪ੍ਰਾਪਤ ਕੀਤੀ ਹੈ ਮੁੱਢਲੀ ਸਿੱਖਿਆ ਉਸ ਤੋਂ ਬਾਅਦ ਮੇਰਾ ਰੁਝਾਨ ਖੇਤੀਬਾੜੀ ਵੱਲ੍ਹ ਹੋ ਗਿਆ ਖੇਤੀਬਾੜੀ ਦੇ ਵਿੱਚ ਮੈਂ ਹੌਲੀ ਹੌਲੀ ਖੇਤੀਬਾੜੀ ਦਾ ਇੰਟਰਸਟ ਜਿਵੇਂ ਜਿਵੇਂ ਮੇਰਾ ਜਾਗਦਾ ਗਿਆ ਮੈਂ ਉਵੇਂ ਉਵੇਂ ਫਿਰ ਖੇਤੀਬਾੜੀ ਵੱਲ੍ਹ ਮੇਰਾ ਰੁਝਾਨ ਵੱਧਦਾ ਗਿਆ ਹੌਲੀ ਹੌਲੀ ਖੇਤੀਬਾੜੀ ਦੇ ਵਿੱਚ ਮੈਂ ਛੇ ਕੁ ਮਹੀਨੇ ਤੱਕ ਜਿਵੇਂ ਕਿ ਹੁਣ ਕਣਕਾਂ ਦੇ ਮੌਸਮ ਚੱਲ ਰਹੇ ਆ ਕਣਕ ਮੈਂ ਆਪਣੇ ਖੇਤਾਂ ਦੇ ਵਿੱਚ ਕਣਕ ਵੀ ਬੀਜੀ ਹੋਈ ਹੈ ਕਣਕ ਆਪਾਂ ਆਪਣੇ ਖੇਤਾਂ ਦੇ ਵਿੱਚ ਮੈਂ ਪਾਪੂਲਰ ਵੀ ਲਗਾਏ ਹੋਏ ਹਨ ਮੈਂ ਪਪੂਲਰਾਂ ਨੂੰ ਹਰੇਕ ਦੋ ਮਹੀਨੇ ਜਾਂ ਮਹੀਨੇ ਬਾਅਦ ਜਿਹੜਾ ਆਪਾਂ ਗੱਲ ਕਰਦੇ ਹਾਂ ਮੱਝਾਂ ਦਾ ਗੋਹਾ ਜਿੱਦਾਂ ਕੀ ਉਹਨੂੰ ਉਹ ਇੱਕ ਕਿਸੇ ਕਿਸਮ ਦਾ ਖਾਦ ਦੇ ਪ੍ਰਕਾਰ ਦੇ ਤੌਰ 'ਤੇ ਵਧੀਆ ਤਰੀਕੇ ਦੇ ਨਾਲ਼ ਵਰਤਿਆ ਜਾਂਦਾ ਹੈ ਉਹ ਵੀ ਮੈਂ ਪਾਉਂਦਾ ਹਾਂ ਆਪਣੇ ਪਪੂਲਰਾਂ ਨੂੰ ਅਤੇ ਨਾਲ ਦੇ ਨਾਲ ਮੈਂ ਆਪਣੇ ਪਪੂਲਰਾਂ ਨੂੰ ਦੋ ਤਿੰਨ ਮਹੀਨੇ ਬਾਅਦ ਖਾਦ ਵੀ ਪਾਉਂਦਾ ਹਾਂ ਅਤੇ ਆਪਣੇ ਪਪੂਲਰ ਨੂੰ ਟਾਈਮ ਟੂ ਟਾਈਮ ਪਾਣੀ ਵੀ ਲਾਉਂਦਾ ਹਾਂ ਖੇਤਾਂ ਨੂੰ ਪਾਣੀ ਵੀ ਲਾਉਂਦਾ ਹਾਂ ਅਤੇ ਕਣਕ ਨੂੰ ਵੀ ਪਾਣੀ ਲਾਉਂਦਾ ਹਾਂ ਕਣਕਾਂ ਦੇ ਵਿੱਚ ਕੀੜਾ ਲੱਗਣ 'ਤੇ ਮੈਂ ਕੀਟ ਨਾਸ਼ਕ ਦਵਾਈਆਂ ਦਾ ਵੀ ਪ੍ਰਯੋਗ ਕਰਦਾ ਹਾਂ ਜਿਸ ਦੇ ਨਾਲ਼ ਮੇਰੀ ਕਣਕ ਬਹੁਤ ਹੀ ਜ਼ਿਆਦਾ ਭਰਪੂਰ ਅਤੇ ਸਾਫ਼ ਸੁਥਰੀ ਐਨ ਫੁੱਲਵੀਂ ਮੈਨੂੰ ਬਣ ਜਾਣੀ ਕਿ ਆਪਾਂ ਗੱਲ ਕੀਤੀ ਜਾਵੇ ਕਿ ਸੇਫ ਸਾਫ਼ ਸੁਥਰੀ ਕਣਕ ਮੈਨੂੰ ਵਧੀਆ ਪ੍ਰਕਾਰ ਦੀ ਮਿਲਦੀ ਹੈ ਅਤੇ ਨਾਲ ਦੇ ਨਾਲ ਮੈਂ ਆਪਣੇ ਘਰ ਦੇ ਵਿੱਚ ਮੱਝਾਂ ਵੀ ਰੱਖੀਆਂ ਹੋਈਆ ਹਨ ਮੇਰੇ ਕੋਲ ਟੌਟਲ ਇਸ ਟਾਈਮ ਤਿੰਨ ਮੱਝਾਂ ਹਨ ਤਿੰਨ ਮੱਝਾਂ ਦਾ ਮੇਰਾ ਦੁੱਧ ਸ਼ਾਮ ਨੂੰ ਡੇਅਰੀ ਦੇ ਵਿੱਚ ਪੈਂਦਾ ਹੈ ਜਿਸ ਦੇ ਨਾਲ਼ ਮੇਰਾ ਫਾਇਦਾ ਹੁੰਦਾ ਹੈ ਜਿਵੇਂ ਕਿ ਪੈਸੇ ਪੁਸੇ ਦਾ ਵਧੀਆ ਘਰ ਬਾਰ ਚੱਲਣ ਨੂੰ ਵਧੀਆ ਮਿਹਨਤ ਕਰਕੇ ਆਪਾਂ ਉਸ ਚੀਜ਼ ਨੂੰ ਸਫ਼ਲ ਕਰ ਸਕਦੇ ਹਾਂ ਅਤੇ ਆਪਾਂ ਇਸ ਟੌਪਿਕ 'ਤੇ ਆਪਾਂ ਗੱਲ ਕਰ ਚੁੱਕੇ ਹਾਂ